ਪੰਜਾਬ ਵਿੱਚ ਬਹੁਤ ਸਾਰੇ ਨਾਚ ਨੱਚੇ ਜਾਂਦੇ ਹਨ ਜਿਨ੍ਹਾਂ ਵਿੱਚ ਲੋਕਾਂ ਦਾ ਸਭ ਤੋਂ ਪ੍ਰਿਯ ਗਿੱਧਾ ਅਤੇ ਭੰਗੜਾ ਹੈ ਜਿਨ੍ਹਾਂ ਵਿੱਚ ਲੋਕਾਂ ਨੂੰ ਇਹ ਦੇਖਣਾ ਬਹੁਤ ਹੀ ਪਸੰਦ ਹੈ ਇਹ ਪੰਜਾਬ ਦੇ ਪ੍ਰਸਿੱਧ ਨਾਚ ਹਨ ਇਹਨਾਂ ਨੂੰ ਹਰ ਮੌਕੇ 'ਤੇ ਨੱਚਿਆ ਜਾਂਦਾ ਹੈ ਇਹ ਕਿਸੇ ਵੀ ਮੌਕੇ 'ਤੇ ਨੱਚਿਆ ਜਾਂਦਾ ਹੈ ਹਰ ਮੌਕੇ 'ਤੇ ਹੀ ਇਸ ਨੂੰ ਲੋਕ ਬਹੁਤ ਹੀ ਉਸਤਾਹ ਉਸ ਉਤਸ਼ਾਹ ਨਾਲ ਕਰਦੇ ਹਨ ਇਹਨਾਂ ਵਿੱਚ ਜਿਹੜੀਆਂ ਇਸਤਰੀਆਂ ਹੁੰਦੀਆਂ ਹਨ ਉਹ ਗਿੱਧੇ ਵਿੱਚ ਬਹੁਤ ਸਾਰੇ ਗਹਿਣੇ ਪਾਉਂਦੀਆਂ ਹਨ ਜਿਨ੍ਹਾਂ ਵਿੱਚ ਸੱਗੀ ਫੁੱਲ ਪਰਾਂਦਾ ਚੂੜੀਆਂ ਟਿੱਕਾ ਆਦਿ ਹੁੰਦਾ ਹੈ ਅਤੇ ਮੁੰਡੇ ਭੰਗੜਾ ਕਰਨ ਵੇਲੇ ਬਹੁਤ ਹੀ ਸਿੰਪਲ ਅਤੇ ਸੋਬਰ ਹੁੰਦੇ ਹਨ ਜਿਨ੍ਹਾਂ ਵਿੱਚ ਗਹਿਣੇ ਪਾਉਣ ਲਈ ਉਹ ਕੈਂਠਾ ਅਤੇ ਘੋੜੀਆਂ ਹੀ ਪਾਉਂਦੇ ਹਨ ਜੋ ਕਿ ਲੋਕਾਂ ਨੂੰ ਦੇਖਣ ਵਿੱਚ ਬਹੁਤ ਹੀ ਸੋਹਣੇ ਲੱਗਦੇ ਹਨ ਇਹ ਨਾਚ ਕਰਦੇ ਸਮੇਂ ਭੰਗੜਾ ਅਤੇ ਗਿੱਧੇ ਗਿੱਧਾ ਕਰਨ ਵਾਲੇ ਲੋਕ ਪਾਏ ਪਾਉਂਦੇ ਹਨ ਇਹ ਕਈ ਤਰ੍ਹਾਂ ਦੇ ਹੁੰਦੇ ਹਨ ਇਹ ਜ਼ਿਆਦਾਤਰ ਲੋਕ ਸੋਨੇ ਅਤੇ ਚਾਂਦੀ ਦੇ ਹੀ ਪਾਏ ਪਾਉਂਦੇ ਹਨ ਇਹ ਸਭ ਤੋਂ ਪ੍ਰਸਿੱਧ ਗਹਿਣੇ ਹਨ ਜੋ ਕਿ ਗਿੱਧੇ ਅਤੇ ਭੰਗੜੇ ਵਿੱਚ ਪਾਏ ਜਾਂਦੇ ਹਨ